ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਦੇ ਸਾਹਮਣੇ ਜੋ ਮੁੱਖ ਮੁੱਦੇ ਅਤੇ ਚੁਣੌਤੀਆਂ ਹਨ ਉਹ ਹੈ ਬੇਰੁਜ਼ਗਾਰੀ ਭਰਿਸ਼ਟਾਚਾਰ ਪੰਜਾਬ ਦਾ ਵਿਕਾਸ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਜਿਹੜੀ ਬੇਰੁਜ਼ਗਾਰੀ ਵੀ ਹੈ ਉਹ ਵੀ ਪੰਜਾਬ ਦੇ ਵਿਕਾਸ ਵਿੱਚ ਮੇਨ ਰੋੜਾ ਬਣ ਰਹੀ ਹੈ ਜੇਕਰ ਬੱਚਾ ਸਾਰੀ ਉਮਰ ਪੜ੍ਹਦਾ ਹੈ ਤਾਂ ਪੜ੍ਹਨ ਤੋਂ ਬਾਅਦ ਉਹਨੂੰ ਨੌਕਰੀ ਨਹੀਂ ਮਿਲਦੀ ਅਤੇ ਦਰ ਦਰ ਦੀਆਂ ਜਗ੍ਹਾ 'ਤੇ ਰੁਲਦਾ ਪਿਆ ਤਾਂ ਵੀ ਉਹ ਜਿਹੜਾ ਦੇਸ਼ ਹੈ ਉਹ ਵਿਕਾਸ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਭਰਿਸ਼ਟਾਚਾਰ ਜੇਕਰ ਪੰਜਾਬ ਦੇ ਕੁਝ ਮਤਲਬ ਕੀ ਆ ਮਤਲਬ ਕੀ ਹੈ ਆਦਮੀ ਜਾਂ ਅਧਿਕਾਰੀ ਭ੍ਰਿਸ਼ਟ ਹੋਣਗੇ ਤਾਂ ਵੀ ਦੇਸ਼ ਦਾ ਜਿਹੜਾ ਵਿਕਾਸ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਜੇਕਰ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਬਾਹਰਲੇ ਰਾਜਾਂ ਦੇ ਵਿੱਚੋਂ ਮਤਲਬ ਕੀ ਹੈ ਵੱਡੀਆਂ ਵੱਡੀਆਂ ਇੰਡਸਟਰੀਆਂ ਉਹ ਪੰਜਾਬ ਵਿੱਚ ਸਥਾਪਿਤ ਕਰਨੀਆਂ ਚਾਹੀਦੀਆਂ ਤਾਂ ਕਿ ਮਤਲਬ ਕੀ ਹੈ ਇੱਥੋਂ ਦੀ ਜਿਹੜੇ ਬੇਰੁਜ਼ਗਾਰ ਬੱਚੇ ਹੈ ਉਹ ਉਹਨਾਂ ਫੈਕਟਰੀਆਂ ਵਿੱਚ ਕੰਮ ਕਰਨ ਉਹਨਾਂ ਦਾ ਜਿਹੜਾ ਜੀਵਨ ਆ ਸੌਖਾ ਹੋਵੇ ਉਹਨਾਂ ਜੀਵਨ ਖੁਸ਼ਹਾਲ ਹੋਵੇ ਇਸ ਤੋਂ ਇਲਾਵਾ ਜਿਹੜੀ ਪੰਜਾਬ ਦੇ ਲੋਕਾਂ ਦੀ ਜਿਹੜੀ ਸੁਰੱਖਿਆ ਵੀ ਹੈ ਉਹ ਵੀ ਪੰਜਾਬ ਦੀ ਮਤਲਬ ਕੀ ਹੈ ਵਿਕਾਸ ਦਾ ਮੁੱਖ ਮੁੱਦਾ ਹੈ